ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਮਲਹੋਤਰਾ ਕਲੋਨੀ ਤੋਂ ਗੱਲ ਕਰ ਰਹੀ ਹਾਂ ਅਤੇ ਸਾਨੂੰ ਇੱਕ ਟੈਕਸੀ ਜਾਂ ਆਟੋ ਬੁੱਕ ਕਰਵਾਉਣਾ ਹੈ ਸਾਡੀ ਰਾ ਸਾਡੀ ਰਾਤ ਨੂੰ ਸਾਢੇ ਗਿਆਰਾਂ ਵਜੇ ਦਿੱਲੀ ਦੇ ਲਈ ਫਲਾ ਦਿੱਲੀ ਦੇ ਲਈ ਟ੍ਰੇਨ ਹੈ ਅਤੇ ਸਾਡ ਅਸੀਂ ਸਵੇਰੇ ਆਪਣੇ ਬ੍ਰਦਰ ਨੂੰ ਫਲਾਈਟ ਦੇ ਵਿੱਚ ਕਨੇਡਾ ਦੀ ਫਲਾਈਟ ਦੇ ਵਿੱਚ ਬਿਠਾਉਣਾ ਹੈ ਅਤੇ ਸਾਨੂੰ ਉਸ ਰਾਤ ਨੂੰ ਰਾਤ ਨੂੰ ਸਾਢੇ ਗਿਆਰਾਂ ਵਜੇ ਤੋਂ ਪਹਿਲਾਂ ਪਹਿਲਾਂ ਇਹ ਇੱਕ ਕੋਈ ਵੀ ਫਲਾਇ ਆਟੋ ਜਾਂ ਟੈਕਸੀ ਦਸ ਵਜੇ ਦੇ ਨੇੜੇ ਨੇੜੇ ਚਾਹੀਦੀ ਹੈ ਤਾਂ ਕਿ ਅਸੀਂ ਉੱਥੇ ਸਮੇਂ ਤੋਂ ਪਹਿਲਾਂ ਪਹੁੰਚ ਜਾਈਏ ਅਤੇ ਉਸ ਸਮੇਂ ਦੇ ਦੌਰਾਨ ਤੁਸੀਂ ਸਾਡੇ ਤੋਂ ਸਾਡੇ ਘਰ ਤੋਂ ਉੱਥੇ ਰੇਲਵੇ ਸਟੇਸ਼ਨ ਤੱਕ ਕਿੰਨਾ ਕਿਰਾਇਆ ਤੁਸੀਂ ਸਾਡੇ ਤੋਂ ਲਓਗੇ ਇਹ ਵੀ ਸਾਨੂੰ ਦੱਸਿਆ ਜਾਵੇ ਅਤੇ ਮੈਂ ਆਪਣਾ ਵਟਸਐਪ ਨੰਬਰ ਤੇ ਆਪਣਾ ਵਟਸਐਪ ਨੰਬਰ ਅਤੇ ਲੋਕੇਸ਼ਨ ਤੁਹਾਡੇ ਉੱਥੇ ਸ ਤੁਹਾਡੇ ਉੱਥੇ ਤੁਹਾਡੇ ਨੰਬਰ 'ਤੇ ਸ਼ੇਅਰ ਕਰ ਦਵਾਂਗੀ ਕਿਰਪਾ ਕਰਕੇ ਮੈਨੂੰ ਆਪਣਾ ਕਿਰਾਇਆ ਤੁਸੀਂ ਕਿਰਾਏ ਦੇ ਨਾਲ ਕਿਰਾਏ ਦੇ ਨਾਲ ਦੱਸਿਆ ਜਾਵੇ ਕਿਰਾਏ ਦੇ ਕਿਰਾਏ ਦੇ ਨਾਲ ਦੱਸਿਆ ਜਾਵੇ ਧੰਨਵਾਦ